ਹਾਂ ਕਲਾਤਮਕ ਉਤਪਾਦਾਂ ਦੀ ਸੁਰੱਖਿਆ ਅਤੇ ਕਾਪੀਰਾਈਟ ਕਰਨ ਲਈ ਕਈ ਵਿਧੀਆਂ ਹਨ ਡਿਜਾਈਨ ਅਧਿਕਾਰ ਕਲਾਤਮਕ ਕੰਮਾਂ ਦੇ ਵਿਲੱਖਣ ਵਿਜੂਅਲ ਪਹਿਲੂਆਂ ਦੀ ਸੁਰੱਖਿਆ ਕਰਦੇ ਹਨ ਜਿਵੇਂ ਕਿ ਫੈਸ਼ਨ ਉਤਪਾਦਾਂ ਜਾਂ ਕਲਾਕਾਰੀ ਲਈ ਡਿਜਾਇਨ ਕਾਪੀਰਾਈਟ ਕਾਨੂੰਨ ਸਿਰਜਣਹਾਰਾਂ ਦੇ ਉਹਨਾਂ ਦੀਆਂ ਮੂਲ ਰਚਨਾਵਾਂ ਦੇ ਅਧਿਕਾਰਾਂ ਦੀ ਰੱਖਿਆ ਕਰਦੇ ਹਨ ਜਿਸ ਵਿੱਚ ਸਾਹਿਤ ਸੰਗੀਤ ਅਤੇ ਵਿਜੁਅਲ ਆਰਟ ਸ਼ਾਮਿਲ ਹਨ ਇਹ ਯਕੀਨੀ ਬਣਾਉਂਦੇ ਹਨ ਕਿ ਉਹ ਆਪਣੀਆਂ ਰਚਨਾਵਾਂ ਨੂੰ ਨਿਯੰਤਰਿਤ ਕਰ ਸਕਦੇ ਹਨ ਅਤੇ ਉਹਨਾਂ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ ਵਿਸ਼ੇਸ਼ ਲਾਈਸੈਂਸ ਕਲਾਕਾਰਾਂ ਨੂੰ ਦੂਜਿਆਂ ਨੂੰ ਵਿਸ਼ੇਸ਼ ਅਧਿਕਾਰ ਦੇਣ ਦੀ ਇਜਾਜ਼ਤ ਦਿੰਦੇ ਹਨ ਅਣਅਧਿਕਾਰਿਤ ਵਰਤੋਂ ਜਾਂ ਫ਼ੰਡ ਦੇ ਵਿਰੁੱਧ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਦੇ ਹਨ ਇਸ ਤੋਂ ਇਲਾਵਾ ਕਲਾਕਾਰ ਲਾਈਸੈਂਸਿੰਗ ਸਮਝੌਤੇ ਇਹ ਪਰਿਭਾਸ਼ਤ ਕਰਨ ਵਿੱਚ ਮਦਦ ਕਰਦੇ ਹਨ ਕਿ ਕੰਮ ਨੂੰ ਵਪਾਰਕ ਤੌਰ 'ਤੇ ਕਿਵੇਂ ਵਰਤਿਆ ਜਾ ਸਕਦਾ ਹੈ ਇਹ ਯਕੀਨੀ ਬਣਾਉਂਦੇ ਹੋਏ ਕਿ ਕਲਾਕਾਰਾਂ ਨੂੰ ਢੁਕਵਾਂ ਮੁਆਵਜ਼ਾ ਮਿਲਦਾ ਹੈ ਅਤੇ ਉਹਨਾਂ ਦੇ ਕੰਮ ਦੀ ਵਰਤੋਂ 'ਤੇ ਕੰਟਰੋਲ ਬਰਕਰਾਰ ਰਹਿੰਦਾ ਹੈ ਕਲਾਤਮਕ ਪੂੰਜੀ ਦੀ ਸੁਰੱਖਿਆ ਵਿੱਚ ਸਰਕਾਰੀ ਸੰਸਥਾਵਾਂ ਅਤੇ ਕਲਾਤਮਕ ਸੰਸਥਾਵਾਂ ਦੋਵੇਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਸਰਕਾਰਾਂ ਬੌਧਿਕ ਸੰਪਤੀ ਦੇ ਅਧਿਕਾਰਾਂ ਲਈ ਕਾਨੂੰਨੀ ਢਾਂਚਾ ਅਤੇ ਲਾਗੂਕਰਨ ਦੀ ਵਿਧੀ ਪ੍ਰਦਾਨ ਕਰਦੀਆਂ ਹਨ ਕਲਾਤਮਕ ਸੰਸਥਾਵਾਂ ਅਕਸਰ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੀਆਂ ਹਨ ਜਿਵੇਂ ਕਿ ਰਜਿਸ਼ਟਰੇਸ਼ਨ ਸਹਾਇਤਾ ਅਤੇ ਕਲਾਕਾਰਾਂ ਦੇ ਅਧਿਕਾਰਾਂ ਦੀ ਵਕਾਲਤ ਰਾਜ ਵਿੱਚ ਕਲਾਤਮਕ ਕੰਮਾਂ ਦੇ ਸੱਭਿਆਚਾਰਕ ਅਤੇ ਆਰਥਿਕ ਮੁੱਲ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਵਿੱਚ ਮਦਦ ਕਰਨਾ